ਅੱਜ ਦੇ ਗੀਤਾਂ ਅਤੇ ਪੁਰਾਣੇ ਗੀਤਾਂ 'ਚ ਬਹੁਤ ਫ਼ਰਕ ਹੈ ਪੁਰਾਣੇ ਗੀਤ ਆਪਾਂ ਘਰੇ ਘਰ 'ਚ ਬੈਠ ਕੇ ਵੀ ਸੁਣ ਸਕਦੇ ਸਨ ਪਰ ਅੱਜ ਦੇ ਗੀਤ ਅਸੀਂ ਘਰ 'ਚ ਬੈਠ ਕੇ ਬੱਚਿਆਂ ਦੇ ਨਾਲ਼ ਨਹੀਂ ਸੁਣ ਸਕਦੇ ਕਿਉਂਕਿ ਇਨ੍ਹਾਂ 'ਚ ਬਹੁਤ ਹੀ ਗ਼ਲਤ ਦਿਖਾਇਆ ਹੋਇਆ ਹੈ ਅਤੇ ਪੁਰਾਣੇ ਗਾਣਿਆਂ ਵਿੱਚ ਸਭ ਕੁੱਛ ਸਹੀ ਹੁੰਦਾ ਸਹੀ ਦਿਖਾ ਦੱਸਿਆ ਜਾਂਦਾ ਸੀਗਾ ਅਤੇ ਗਾਣੇ ਦਿਲ ਨੂੰ ਛੂਹਣ ਵਾਲੇ ਹੁੰਦੇ ਅੱਜ ਕੱਲ੍ਹ ਦੇ ਗਾਣਿਆ 'ਚ ਤਾਂ ਢੋਲ ਢਲੱਮੇ ਹੀ ਵੱਜਦੇ ਹਨ ਪਰ ਪੁਰਾਣੇ ਗਾਣਿਆ 'ਚ ਘਰ ਦੇ ਬਾਰੇ ਵੀ ਦੱਸਿਆ ਹੋਇਆ ਜਾ ਜਾਂਦਾ ਸੀਗਾ ਅਤੇ ਪਰਿਵਾਰ 'ਚ ਬੈਠ ਕੇ ਅਸੀਂ ਸੁਣ ਸਕਦੇ ਸਨ